ਭਾਰਤ ਦੀ ਸਿੱਖਿਆ ਪ੍ਰਣਾਲੀ ਬਹੁਤ ਹੀ ਜ਼ਿਆਦਾ ਭਾਰਤ ਦੀ ਸਿੱਖਿਆ ਪ੍ਰਣਾਲੀ ਬਾਰੇ ਸੋਚਣ ਵਾਲੀ ਗੱਲ ਹੈ ਕਿਉਂਕੀ ਭਾਰਤ ਦੀ ਸਿੱਖਿਆ ਪ੍ਰਣਾਲੀ ਹੈ ਉਹ ਪੰਜ ਦੇ ਬੱਚਿਆਂ ਨੂੰ ਵੱਖ ਵੱਖ ਵਿਸ਼ਿਆਂ ਦੇ ਵਿੱਚ ਉਲਝਾ ਕੇ ਰੱਖ ਦਿੰਦੀ ਹੈ ਉਹ ਕਦੇ ਵੀ ਬੱਚੇ ਦੀ ਰੁਚੀ ਦੇ ਹਿਸਾਬ ਨਾਲ ਉਸਦੇ ਵਿਸ਼ਿਆਂ ਨੂੰ ਉਸ ਨੂੰ ਚੁਣਨ ਦਾ ਉਸਨੂੰ ਹੱਕ ਨਹੀਂ ਦਿੰਦੀ ਉਹ ਉਸ ਨੂੰ ਹਮੇਸ਼ਾ ਵੱਖ ਵੱਖ ਜੋ ਵਿਸ਼ੇ ਹੈ ਉਹ ਪੜ੍ਹਾਉਂਦੀ ਹੈ ਤੇ ਪੜ੍ਹਾਉਣ ਤੇ ਮਜਬੂਰ ਕਰਦੀ ਹੈ ਤੇ ਉਨ੍ਹਾਂ ਦੀ ਪੜ੍ਹਾਈ ਦੇ ਉੱਤੇ ਬੱਚਾ ਆਪਦਾ ਉਹਦਾ ਫੈਸਲਾ ਲੈਣਾ ਉਹਨੂੰ ਮੁਸ਼ਕਲ ਹੋ ਜਾਂਦਾ ਹੈ ਕਿਉਂਕੀ ਉਹ ਆਪਣੇ ਆਪ ਨੂੰ ਆਪਣੇ ਨਾਲ ਦੇ ਬੱਚਿਆਂ ਦੇ ਹਿਸਾਬ ਨਾਲ ਕਮਤਰ ਮਹਿਸੂਸ ਕਰਦਾ ਹੈ ਤਾਂ ਉਸਨੂੰ ਇਹ ਸੋਚਣਾ ਕਿ ਵੀ ਮੇਰੀ ਰੁਚੀ ਕਿਸ ਵਿੱਚ ਹੈ ਤੇ ਮੈਂ ਕਿਸ ਵਿਸ਼ੇ ਦੇ ਵਿੱਚ ਅੱਗੇ ਜਾ ਸਕਦਾ ਹਾਂ ਬਹੁਤ ਮੁਸ਼ਕਿਲ ਹੈ ਜਦ ਕੀ ਜੇ ਦੇਖਿਆ ਜਾਵੇ ਤਾਂ ਬਾਹਰਲੇ ਸੂਬਿਆਂ ਦੇ ਵਿੱਚ ਜੋ ਵਿਸ਼ੇ ਬੱਚਿਆਂ ਨੂੰ ਖਾਸ ਵਿਸ਼ੇ ਦੇ ਹਿਸਾਬ ਤੇ ਤਿਆਰ ਕੀਤਾ ਜਾਂਦਾ ਹੈ ਕਿ ਜਿਸ ਵਿੱਚ ਬੱਚੇ ਦੀ ਰੁਚੀ ਹੈ ਉਹਨੂੰ ਜਾਣਨ ਤੋਂ ਬਾਅਦ ਹੀ ਉਹਦੀ ਉਹਦੀਆਂ ਹਰਕਤਾਂ ਦੇ ਹਿਸਾਬ ਨਾਲ ਉਹਨੂੰ ਦੇਖਿਆ ਜਾਂਦਾ ਹੈ ਕਿ ਬਾਕਿਆ ਬੱਚਾ ਕਿਸ ਚੀਜ ਦੇ ਵਿੱਚ ਜਿਆਦਾ ਰੁਚੀ ਦਿਖਾਉਂਦਾ ਹੈ ਚਾਹੇ ਉਹ ਖੇਡ ਹੋਵੇ ਚਾਹੇ ਉਹ ਪੜ੍ਹਾਈ ਦੇ ਵਿੱਚ ਕੋਈ ਖਾਸ ਵਿਸ਼ਾ ਹੋਵੇ ਉਸ ਤਰੀਕੇ ਦੇ ਹਿਸਾਬ ਨਾਲ ਉਨ੍ਹਾਂ ਦੀ ਪੜ੍ਹਾਈ ਹੈ ਜੋ ਕੀਤੀ ਜਾਣਦੀ ਹੈ ਤਾਂ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਵੀ ਅਗਰ ਤੁਹਾਡੀ ਰੁਚੀ ਇਸ ਵਿੱਚ ਹੈ ਤਾਂ ਉਸਨੂੰ ਹੋਰ ਨਿਹਾਰਨ ਦੇ ਲਈ ਉਹਦੀ ਮਦਦ ਕਰੀ ਜਾਂਦੀ ਹੈ ਤੇ ਉਸਨੂੰ ਓਹੀ ਵਿਸ਼ਾ ਪੜ੍ਹਾਇਆ ਜਾਂਦਾ ਹੈ ਨਾ ਕਿ ਉਸਨੂੰ ਵਾਧੂ ਦੇ ਵਿਸ਼ੇ ਹੋਰ ਵਿਸ਼ਿਆਂ ਦੇ ਬਾਰੇ ਦੱਸ ਕੇ ਉਹਨੂੰ ਗੁੰਮਰਾਹ ਕੀਤਾ ਜਾਂਦਾ ਹੈ ਜੇ ਦੇਖਿਆ ਜਾਵੇ ਤਾਂ ਇਸ ਤੇ ਇਸ ਦੇ ਵਿੱਚ ਸੁਧਾਰ ਲਿਆਣ ਦੇ ਲਈ ਬੱਚਿਆਂ ਨੂੰ ਘੱਟੋ ਘੱਟ ਪੰਜਵੀਂ ਜਮਾਤ ਤੱਕ ਇਹ ਹੱਕ ਉਨ੍ਹਾਂ ਨੂੰ ਦੇਣਾ ਚਾਹੀਂਦਾ ਹੈ ਕੀ ਉਹ ਸੋਚ ਸਕਣ ਕਿ ਵੀ ਉਨ੍ਹਾਂ ਦੀ ਰੁਚੀ ਕਿਸ ਕਿਸ ਪ੍ਰਤੀ ਹੈ ਤੇ ਉਹ ਆਪਣੀ ਰੁਚੀ ਦੇ ਅਨੁਸਾਰ ਆਪਣੇ ਆਹ ਜਿਹੜੇ ਅੱਗੇ ਦੇ ਫੈਸਲੇ ਐ ਉਹ ਲੈ ਸਕਣ